ਜੀ ਹਾਂ ਸਾਡੇ ਵਿਹੜੇ ਵਿੱਚ ਬਾਗ ਅਤੇ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਮੈਂ ਬਹੁਤ ਕੁਛ ਲਗਾਇਆ ਹੋਇਆ ਹੈ ਬਾਗ ਵਿੱਚ ਮੈਂ ਤਰ੍ਹਾਂ ਤਰ੍ਹਾਂ ਦੇ ਫੁੱਲ ਪੌਦੇ ਲਗਾਏ ਹੋਏ ਹਨ ਜਿਸ ਨੂੰ ਦੇਖ ਕਰ ਪੰਛੀ ਆਕਰਸ਼ਿਤ ਹੋ ਜਾਂਦੇ ਹਨ ਤਰ੍ਹਾਂ ਤਰ੍ਹਾਂ ਦੇ ਗੁਲਾਬ ਵੀ ਲਗਾਏ ਹਨ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਫੁੱਲ ਲਗਾਏ ਹੋਏ ਹਨ ਜਿਹਨੂੰ ਦੇਖਣ ਨਾਲ ਪੰਛੀ ਆਕਰਸ਼ਿਤ ਹੋ ਜਾਂਦੇ ਹਨ ਮੈਂ ਤਰ੍ਹਾਂ ਤਰ੍ਹਾਂ ਦੇ ਰੰਗੀਨ ਖਿਡੌਣੇ ਵੀ ਲਗਾਏ ਹੋਏ ਹਨ ਜਿਸ ਨੂੰ ਦੇਖ ਕੇ ਵੀ ਪੰਛੀ ਆਕਰਸ਼ਿਤ ਹੋ ਜਾਂਦੇ ਹਨ ਮੈਨੂੰ ਬਾਗ ਨੂੰ ਵੀ ਤਿਆਰ ਕਰਨਾ ਬਹੁਤ ਚੰਗਾ ਲੱਗਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਪੇੜ ਪੌਦੇ ਲਗਾਉਣੇ ਵੀ ਚੰਗੇ ਲੱਗਦੇ ਹਨ ਅਤੇ ਮੈਨੂੰ ਪੰਛੀ ਵੀ ਦੇਖਣੇ ਬਹੁਤ ਚੰਗੇ ਲੱਗਦੇ ਹਨ ਮੈਂ ਆਪਣੇ ਬਾਗ ਅਤੇ ਵਿਹੜੇ ਵਿੱਚ ਪੰਛੀਆਂ ਦੇ ਅਨਾਜ ਅਤੇ ਪਾਣੀ ਵੀ ਰੱਖਿਆ ਹੋਇਆ ਹੈ ਜਿਸ ਨੂੰ ਪੰਛੀ ਰੋਜ਼ ਆ ਕੇ ਦਾਣਾ ਚੁੱਗਦੇ ਹਨ ਅਤੇ ਪਾਣੀ ਪੀਂਦੇ ਹਨ ਰੋਜ਼ ਮੈਂ ਪਾਣੀ ਅਤੇ ਅਨਾਜ ਵਾਲੇ ਬਰਤਨ ਨੂੰ ਵੀ ਸਾਫ ਕਰਦੀ ਹਾਂ ਅਤੇ ਉਸ ਦੇ ਵਿੱਚ ਰੋਜ਼ ਤਾਜ਼ਾ ਪਾਣੀ ਅਤੇ ਤਾਜ਼ਾ ਅਨਾਜ ਰੱਖਦੀ ਹਾਂ ਜਿਸ ਨੂੰ ਪੰਛੀ ਰੋਜ਼ ਖਾਣ ਆਉਂਦੇ ਹਨ ਅਤੇ ਪਾਣੀ ਵੀ ਪੀਣ ਆਉਂਦੇ ਹਨ ਮੈਨੂੰ ਤਰ੍ਹਾਂ ਤਰ੍ਹਾਂ ਦੇ ਪੰਛੀ ਰੱਖਣੇ ਵੀ ਚੰਗੇ ਲੱਗਦੇ ਹਨ ਔਰ ਦੇਖਣੇ ਵੀ ਚੰਗੇ ਲੱਗਦੇ ਹਨ ਬਾਗ ਅਤੇ ਵਿਹੜੇ ਨੂੰ ਮੈਂ ਬਹੁਤ ਸੋਹਣੇ ਸੋਹਣੇ ਰੰਗਾਂ ਨਾਲ ਵੀ ਸਜਾਇਆ ਹੋਇਆ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ ਨਾਲ ਹੋਰ ਸੋਹਣਾ ਵੀ ਉਸਨੂੰ ਬਣਾਇਆ ਹੋਇਆ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਫੋਟੋਆਂ ਅਤੇ ਪ ਪੰਛੀਆਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਰੱਖੀਆਂ ਹੋਈਆਂ ਹਨ ਜਿਸ ਨੂੰ ਦੇਖ ਕੇ ਪੰਛੀ ਬਹੁਤ ਆਕਰਸ਼ਿਤ ਹੋ ਜਾਂਦੇ ਹਨ ਅਤੇ ਆਉਂਦੇ ਹਨ ਅਤੇ ਬਾਗ ਵਿੱਚ ਆ ਕੇ ਅਨਾਜ ਅਤੇ ਪਾਣੀ ਵੀ ਪੀਂਦੇ ਹਨ